ਸਤਿ ਸ਼੍ਰੀ ਅਕਾਲ ਜੀ ਤੁਸੀਂ ਗਾਓ ਦੇ ਸਰਪੰਚ ਬੋਲਦੇ ਪਏ ਹੈਗੇ ਆ ਮੈਂ ਨਾ ਪਿੰਡ ਵਿੱਚ ਰਹਿੰਦੀ ਆ ਤੇ ਮੈਨੂੰ ਨਾ ਇੱਕ ਬਹੁਤ ਬੜੀ ਸਮੱਸਿਆ ਹੈਗੀ ਆ ਮੈਂ ਕਹਿਣਾ ਕਿ ਜਿਦਾਂ ਲੋਕੀ ਖੇਤੀ ਕਰਦੇ ਆ ਉਹਤੋਂ ਬਾਅਦ ਪਰਾਲੀ ਜਲਾਉਂਦੇ ਹੈਗੇ ਨਾ ਬਹੁਤ ਜਿਆਦਾ ਧੂਆ ਹੁੰਦਾ ਸਾਨੂੰ ਅੱਜ ਕੱਲ ਦੇ ਯੂਥ ਸਾਡੇ ਬੱਚੇ ਨਿਆਣੇ ਬੁੱਢੇ ਉਹਨਾਂ ਨੂੰ ਸਾਹ ਲੈਣ ਤੋਂ ਬਹੁਤ ਜਿਆਦਾ ਦਿੱਕਤ ਆਂਦੀ ਪਈ ਹੈਗੀ ਆ ਤੁਹਾਨੂੰ ਇਹੀ ਪਰੇਸ਼ਾਨੀ ਆਉਂਦੀ ਸੀ ਮੈਂ ਤੁਹਾਨੂੰ ਤਾਂ ਨਹੀਂ ਲਿਆ ਜਾਂਦਾ ਹੈਗਾ ਠੀਕ ਐ ਉਸ ਤੋਂ ਬਾਅਦ ਇਨਾ ਜਿਆਦਾ ਪ੍ਰਦੂਸ਼ਣ ਹੋ ਗਿਆ ਕਿ ਦਿਖਣਾ ਬੰਦ ਹੋ ਗਿਆ ਇਨਾ ਪ੍ਰਦੂਸ਼ਨ ਤੋਂ ਜਿਆਦਾ ਸਭ ਤੋਂ ਜਿਆਦਾ ਸਮੱਸਿਆ ਆਉਂਦੀ ਬੁੱਢੀਆਂ ਨੂੰ ਬੁੱਢਿਆਂ ਨੂੰ ਅਸਥਮਾ ਹੁੰਦਾ ਪਿਆ ਅਜਕੱਲ ਅਸਥਮਾ ਦੇ ਨਾਲ ਬੰਦਿਆਂ ਨੂੰ ਕੈਂਸਰ ਵੀ ਹੋ ਜਾਂਦੇ ਆ ਇਸ ਲਈ ਮੈਂ ਤੁਹਾਡੇ ਕੋਲ ਇਹ ਲੈ ਕੇਸ ਲਾ ਲੈ ਕੇ ਆਈ ਕਿ ਤੁਸੀਂ ਕੁਛ ਨਾ ਕੁਛ ਕਰੋ ਕਿ ਪਰਾਲੀ ਘੱਟ ਤੋਂ ਘੱਟ ਸਾੜੀ ਜਾਵੇ

ਮੈਂ ਦੇਖੋ ਮੈਂ ਸਹੀ ਗੱਲ ਦੱਸਾ ਕਿ ਮੇਰਾ ਪਿਤਾ ਜੀ ਪਿਤਾ ਜੀ ਹੈਗੇ ਉਹ ਵੀ ਕਿਸਾਨ ਹੈ ਤੇ ਉਹ ਵੀ ਪੁਰਾਣੀ ਜਲਾਂਦੇ ਹੈਗੇ ਆ ਪਰ ਮੈਂ ਉਹਨਾਂ ਨੂੰ ਸਮਝਾ ਸਮਝਾ ਕਿ ਪਰਾਲੀ ਨਹੀਂ ਚਲਾਉਣੀ ਚਾਹੀਦੀ ਹੈਗੀ ਸਾਨੂੰ ਇਦਾਂ ਕਰਨਾ ਚਾਹੀਦਾ ਪਰਾਈ ਨੂੰ ਮਤਲਬ ਮਿੱਟੀ ਉਹਨੂੰ ਖੋਦ ਕੇ ਉਹਦੇ ਵਿੱਚ ਹੀ ਪਾਣੀ ਦਿੰਦੇ ਆ

ਦੇਖੋ ਮੇਰੀ ਗੱਲ ਸੁਣੋ ਤੇ ਮੈਂ ਆਪਣੇ ਇਹ ਪਿਓ ਨੂੰ ਸਮਝਾਉਗੀ ਕੱਲੈ ਨੂੰ ਇਕੱਲੇ ਸਮਝਾ ਕੱਲੇ ਬੰਦੇ ਸਮਝਾਣਾ ਔਖਾ ਆ ਤੁਸੀਂ ਸਰਪੰਚ ਤੁਸੀਂ ਸਾਰੇ ਕਿਸਾਨਾਂ ਨੂੰ ਇਕੱਠੇ ਕਰੋ ਤੁਸੀਂ ਉਹਨਾਂ ਨੂੰ ਵੀ ਸੁਣੋ ਇਹ ਸਾਰਿਆਂ ਦੀ ਇੱਕ ਇੱਕ ਗੱਲ ਸੁਣੋ ਉਹ ਕੀ ਕਹਿੰਦੇ ਨੇ ਤੇ ਤਾਂਹੀ ਆਪਾਂ ਇਸ ਦਾ ਮਤਲਬ ਨਿਵਾਰਨ ਕਰ ਪਾਵਾਂਗੇ ਕੁਛ ਠੀਕ ਹੈ ਮੈਂ ਟੈਂਸ਼ਨ ਬਟ ਟੈਂਸ਼ਨ ਇਸ ਗੱਲ ਦੀ ਨਹੀਂ ਟੈਂਸ਼ਨ ਇਸ ਗੱਲ ਦੀ ਕਿ ਲੋਕੀ ਬਿਮਾਰ ਬਹੁਤ ਹੋ ਰਹੇ ਆ ਲੋਕਾਂ ਨੂੰ ਫਿਰ ਹੋਸਪੀਟਲ ਜਾਣਾ ਪੈਣਾ ਲੋਕਾਂ ਦਾ ਖਰਚਾ ਵੱਧਦਾ ਪਿਆ ਠੀਕ ਹੈ ਸਾਡੇ ਸਿਰਫ ਵਾਤਾਵਰਨ ਵੀ ਇਹਨਾਂ ਦੁਸ਼ਿਤ ਹੁੰਦਾ ਆ ਤੁਹਾਡੀ ਆਉਣ ਵਾਲੀ ਪੀੜੀ ਤੇ ਬਹੁਤ ਜਿਆਦਾ ਅਸਰ ਪਊਗਾ ਠੀਕ ਹੈ ਮੇਰੀ ਗੱਲ ਸਰਪੰਚ ਜੀ ਤੁਸੀਂ ਜੋ ਮਰਜ਼ੀ ਕਰੋ ਪਰ ਤੁਸੀਂ ਸਭ ਤੋਂ ਪਹਿਲਾਂ ਇੱਕ ਕਿਸਾਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਵੀ ਗੱਲ ਸੁਣੋ ਉਹਨਾਂ ਨੂੰ ਵੀ ਇੱਕ ਨੰਬਰ ਤੇ ਰੱਖੋ ਕਿ ਉਹ ਕੀ ਕਹਿੰਦੇ ਆ ਫਿਰ ਹੀ ਕੁਝ ਹੋ ਸਕਦਾ ਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ